ਮੇਰੇ ਖਿਆਲ ਵਿੱਚ ਡਾਂਸ ਬਾਰੇ ਸਭ ਤੋਂ ਵੱਡੀ ਗਲਤਫਹਿਮੀ ਇਹ ਹੈ ਕਿ ਡਾਂਸ ਸੌਖਾ ਹੁੰਦਾ ਹੈ ਵੀ ਹੱਥ ਪੈਰ ਹੀ ਹਿਲਾਣੇ ਹੁੰਦੇ ਨੇ ਵੀ ਡਾਂਸ ਹੋ ਜਾਂਦਾ ਪਰ ਇਹ ਸਭ ਤੋਂ ਵੱਡੀ ਗਲਤਫਹਿਮੀ ਹੈ ਡਾਂਸ ਕੋਈ ਸੌਖੀ ਚੀਜ਼ ਨਹੀਂ ਹੈ ਡਾਂਸ ਨੂੰ ਕਰਨ ਲਈ ਬਹੁਤ ਜਿਆਦਾ ਮਿਹਨਤ ਦੀ ਲੋੜ ਹੁੰਦੀ ਹੈ ਧੰਨਵਾਦ